ਹਾਂ ਮੈਂ ਪੰਜਾਬੀ ਦੀ ਇੱਕ ਖੇਤਰੀ ਉਪਭਾਸ਼ਾ ਬਾਰੇ ਜਾਣਦਾ ਹਾਂ ਜਿਸ ਨੂੰ ਕਿ ਪੁਆਧੀ ਕਿਹਾ ਜਾਂਦਾ ਹੈ ਇਹ ਭਾਸ਼ਾ ਬਹੁਤ ਹੀ ਸਰਲ ਹੈ ਕਿਉਂਕਿ ਇਸ ਦਾ ਪੰਜਾਬੀ ਵਾਂਗ ਹੀ ਬੋਲਿਆ ਜਾਂਦੀ ਹੈ ਇਸ ਵਿੱਚ ਥੋੜ੍ਹਾ ਜਿਹਾ ਫਰਕ ਹੈ ਮੇਰੀ ਆਮ ਉਪਭਾਸ਼ਾ ਮਲਵਈ ਹੈ ਅਤੇ ਉਸ ਨਾਲ ਹੀ ਇਹ ਮਿਲਦੀ ਜੁਲਦੀ ਹੈ ਇਸ ਵਿੱਚ ਕਿਉਂਕਿ ਇਹ ਉਪਭਾਸ਼ਾ ਮੇਰੇ ਰਿਸ਼ਤੇਦਾਰ ਬੋਲਦੇ ਹਨ ਤਾਂ ਇਸ ਬਾਰੇ ਮੈਨੂੰ ਥੋੜ੍ਹੀ ਬਹੁਤੀ ਨੌਲੇਜ ਹੈ ਪੰਜਾਬੀ ਦੀਆਂ ਤਿੰਨ ਉਪਭਾਸ਼ਾਵਾਂ ਹਨ ਜਿਵੇਂ ਕਿ ਮਾਝਾ ਮਲਵਈ ਦੁਆਬੀ ਅਤੇ ਇੱਕ ਹੋਰ ਉਪਭਾਸ਼ਾ ਹੈ ਜਿਸ ਨੂੰ ਕਿ ਪੁਆਧੀ ਕਿਹਾ ਜਾਂਦਾ ਹੈ ਇਹ ਉਪਭਾਸ਼ਾ ਵੀ ਪੰਜਾਬ ਵਿੱਚ ਵਰਤੀ ਜਾਂਦੀ ਹੈ ਇਹ ਉਪਭਾਸ਼ਾ ਪੰਜਾਬ ਦੇ ਡੇਰਾ ਬਸੀ ਪੁਆ ਪਟਿਆਲਾ ਆਦਿ ਸ਼ਹਿਰਾਂ ਵਿੱਚ ਵਰਤੀ ਜਾਂਦੀ ਹੈ